ਸਤਿ ਸ਼੍ਰੀ ਅਕਾਲ ਜੀ ਰੈੱਡਮੀ ਦੇ ਸਟੋਰ ਤੋਂ ਗੱਲ ਰਹੇ ਅਸੀਂ ਕੁਛ ਦਿਨ ਪਹਿਲਾਂ ਤੁਹਾਡੇ ਸਟੋਰ ਤੋਂ ਫ਼ੋਨ ਮੰਗਵਾਇਆ ਸੀ ਰੈੱਡਮੀ ਨਾਈਨ ਪਰਾਈਮ ਅਤੇ ਜਦੋਂ ਫ਼ੋਨ ਸਾਡੇ ਕੋਲ ਆਇਆ ਸਭ ਤੋਂ ਪਹਿਲਾਂ ਤਾਂ ਉਸਦੀ ਪੈਕੇਜਿੰਗ ਫਟੀ ਹੋਈ ਜਦੋਂ ਫ਼ੋਨ ਕੱਢਿਆ ਤਾਂ ਫ਼ੋਨ ਦੀ ਸਕਰੀਨ ਦੇ ਵੀ ਸਕਰੈਚ ਪਏ ਹੋਏ ਅਤੇ ਬੈਕ ਕਵਰ ਵੀ ਖਰਾਬ ਹੋਇਆ ਹੋਇਆ ਜਦੋਂ ਅਸੀਂ ਫ਼ੋਨ ਔਨ ਕੀਤਾ ਸਭ ਤੋਂ ਪਹਿਲਾਂ ਤਾਂ ਉਹ ਅੋਨ ਨਹੀਂ ਹੋਇਆ ਅਤੇ ਅੋਨ ਹੋਣ ਤੋਂ ਬਾਅਦ ਵੀ ਹੈਂਗ ਹੋ ਹੋ ਕੇ ਚੱਲਿਆ ਉਸਦਾ ਕੈਮਰਾ ਚੈੱਕ ਕੀਤਾ ਤਾਂ ਉਸਦਾ ਫਰੰਟ ਕੈਮਰਾ ਹੀ ਨਹੀਂ ਚੱਲ ਰਿਹਾ ਡਿਸਪਲੇਅ ਵੀ ਪੂਰੀ ਤਰ੍ਹਾਂ ਨਹੀਂ ਆ ਰਹੀ ਅਤੇ ਨਾ ਤਾਂ ਫ਼ੋਨ ਚਾਰਜ ਹੋ ਰਿਹਾ ਛੇਤੀ ਅਤੇ ਚਾਰਜ ਹੋਣ ਤੋਂ ਬਾਅਦ ਵੀ ਬੈਟਰੀ ਬਿਲਕੁਲ ਨਹੀਂ ਰਹਿੰਦੀ ਉਸਦੀ ਅਤੇ ਅਸੀਂ ਜਦੋਂ ਬਾਹਰੋਂ ਵੀ ਪਤਾ ਕੀਤਾ ਫ਼ੋਨ ਦੇ ਰਿਗਾਰਡਿੰਗ ਤਾਂ ਉੱਥੋ ਸਾਨੂੰ ਪਤਾ ਲੱਗਾ ਕਿ ਬਾਹਰ ਤਾਂ ਫ਼ੋਨ ਹੋਰ ਵੀ ਸਸਤਾ ਏ